ਪੰਜਾਬ ਵਿੱਚ ਕਾਰੋਬਾਰਾਂ ਦਾ ਸਾਹਮਣਾ ਕਰਨ ਵਾਲੀਆਂ ਮੁੱਖ ਚੁਣੌਤੀਆਂ ਇਹ ਹਨ ਕਿ ਸਾਡਾ ਪੰਜਾਬ ਵਿੱਚ ਆਪਣਾ ਵੀ ਇੱਕ ਕਾਰੋਬਾਰ ਹੈ ਜਿਸ ਵਿੱਚ ਸਾਡੇ ਕੋਲ ਕਈ ਤਰ੍ਹਾਂ ਦੇ ਗਾਹਕ ਆਉਂਦੇ ਹਨ ਅਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਡੀਲ ਕਰਦੇ ਹਾਂ ਅੱਜ ਕੱਲ੍ਹ ਮੰਦੀ ਬੜੀ ਛਾਈ ਹੋਈ ਹੈ ਅਤੇ ਕਸਟਮਰ ਬਹੁਤ ਘੱਟ ਹੈ ਮਾਰਕੀਟ ਵਿੱਚ ਜਿਸ ਦੇ ਕਾਰਨ ਸਾਡੇ ਕਾਰੋਬਾਰ ਵੀ ਥੋੜ੍ਹੇ ਠੰਡੇ ਪਏ ਹੋਏ ਹਨ ਕੁਛ ਕਸਟਮਰ ਇੱਦਾਂ ਦੇ ਹੁੰਦੇ ਹਨ ਜਿੱਦਾਂ ਉਹ ਚੀਜ਼ ਦੀ ਚੋਇਸ ਕਰਦੇ ਹਨ ਅਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਮਤਲਬ ਦੀ ਚੀਜ਼ ਦੇਈ ਦੀ ਹੈ ਪਰ ਉਹ ਉਹਨਾਂ ਦੀ ਪੋਕਿਟ ਓਨੀ ਪ੍ਰਾਈਸ ਅਲਾਓ ਨਹੀਂ ਕਰਦੀ ਅਤੇ ਇਸ ਕਰਕੇ ਉਹ ਉਸ ਚੀਜ਼ ਨੂੰ ਲੈ ਨਹੀਂ ਪਾਉਂਦੇ ਸਾਡੇ ਦੁਕਾਨ 'ਤੇ ਕਈ ਮਾਲ ਦੀ ਵੀ ਕਮੀ ਪੈ ਜਾਂਦੀ ਹੈ ਕਿਉਂਕਿ ਸਾਡੀ ਆਰਥਿਕ ਹਾਲਤ ਇੰਨੀ ਵਧੀਆ ਨਹੀਂ ਹੈ ਕਿ ਅਸੀਂ ਮਾਲ ਜ਼ਿਆਦਾ ਤੋਂ ਜ਼ਿਆਦਾ ਭਰ ਸਕੀਏ ਜਿਹਦੇ ਕਾਰਨ ਕਈ ਵਾਰੀ ਸਾਡਾ ਗਾਹਕ ਟੁੱਟ ਜਾਂਦਾ ਹੈ ਅਤੇ ਅੱਜ ਕੱਲ੍ਹ ਤਾਂ ਆਨਲਾਈਨ ਨੇ ਬੜੇ ਕੰਮ ਖ਼ਰਾਬ ਕੀਤੇ ਹੋਏ ਹਨ ਜਿਹਦੇ ਕਾਰਨ ਸਾਡੇ ਵਪਾਰੀਆਂ ਦੇ ਬਿਜਨਸ ਨੂੰ ਬੜਾ ਘਾਟਾ ਹੋ ਰਿਹਾ ਹੈ ਕਿਉਂਕਿ ਉਹ ਲੋਕ ਆਨਲਾਈਨ ਕਰਕੇ ਦੁਕਾਨਦਾਰੀ ਸਾਰੀ ਸਾਡੀ ਖ਼ਤਮ ਕਰ ਰਹੇ ਹਨ ਜਿਹਦੇ ਕਾਰਨ ਸਾਨੂੰ ਅਤੇ ਸਾਡੇ ਹੋਰ ਭਰਾਵਾਂ ਨੂੰ ਬੜਾ ਵੱਡਾ ਨੁਕਸਾਨ ਹੋ ਰਿਹਾ ਹੈ